ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਨਿਕੁੰਜ ਨੇ ਤੁਹਾਡਾ ਨੰਬਰ ਦਿੱਤਾ ਸੀ ਉਹਨਾਂ ਦਾ ਤੁਹਾਨੂੰ ਫੋਨ ਆਇਆ ਹੋਵੇਗਾ ਮੈਂ ਮਨੀਸ਼ਾ ਬੋਲ ਰਹੀ ਹੈਂ ਮੈਨੂੰ ਨਿਕੁੰਜ ਜੀ ਨੇ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਗੱਲ ਕਰ ਲਵਾਂ ਕਪੂਰਥਲੇ ਬਾਰੇ ਠੀਕ ਹੈ ਠੀਕ ਹੈ ਸਰ ਮੈਂ ਤੁਹਾਨੂੰ ਪੁੱਛਣਾ ਸੀ ਕਿ ਮੈਂ ਹੈਗੀ ਆ ਇਸ ਟਾਈਮ ਜੰਮੂ ਨਾ ਅਤੇ ਜੰਮੂ ਤੋਂ ਮੈਂ ਆਉਣਾ ਕਪੂਰਥਲੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਮੇਰੇ ਵਾਸਤੇ ਕੀ ਬੈਟਰ ਰਹੇਗਾ ਕਿ ਮੈਂ ਬੱਸ 'ਚ ਆਵਾਂ ਜਾਂ ਬਾਏ ਟਰੇਨ ਆਵਾਂ ਓਕੇ ਓਕੇ ਠੀਕ ਹੈ ਠੀਕ ਹੈ

ਓਕੇ ਅਤੇ ਜੇ ਮੈਂ ਆਪਣੀ ਕਨਵੈਨਸ 'ਤੇ ਆਉਣਾ ਚਾਹਵਾਂ ਮਤਲਬ ਬਾਏ ਕਾਰ ਨਹੀਂ ਨਹੀਂ ਮੈਂ ਇਕੱਲੀ ਓਈਆਂ ਸਰ ਅੱਛਾ ਜੀ ਠੀਕ ਹੈ ਤਾਂ ਤੁਸੀਂ ਮੈਨੂੰ ਦੱਸੋਗੇ ਵੀ ਕਪੂਰਥਲੇ 'ਚ ਹੋਰ ਕੀ ਹੈ ਘੁੰਮਣ ਨੂੰ ਐਕਚੁਲੀ ਮੈਂ ਕਿਸੇ ਕੰਮ ਆਉਣਾ ਸੀ ਤਾਂ ਮੈਂ ਸੋਚਿਆ ਕਿ ਇਹਨੂੰ ਕਿਸੇ ਆਪਣੇ ਟਾਈਮ ਨੂੰ ਕਿਸੇ ਹੋਰ ਪਾਸੇ ਵੀ ਯੂਟੀਲਾਈਜ ਕਰ ਲਵਾਂ ਵੀ ਇੱਕ ਮੈਂ ਸੁਣਿਆ ਇੱਥੇ ਗੁਰੂ ਨਾਨਕ ਬੈਰ ਟੂ ਬੇਰ ਸਾਹਿਬ ਗੁਰਦੁਆਰਾ ਉਹ ਦੱਸੋਗੇ ਉੱਥੋਂ ਕਿੰਨੀ ਕੁ ਦੂਰ ਹੈ ਅੱਛਾ ਜੀ ਠੀਕ ਹੈ ਅਤੇ ਇੱਥੇ ਕੋਈ ਸਾਇੰਸ ਸਿਟੀ ਵੀ ਹੈ ਮੈਂ ਉਹਦੇ ਬਾਰੇ ਵੀ ਬਹੁਤ ਸੁਣਿਆ ਹੈ ਓਕੇ ਅਤੇ ਆ ਕਿੰਨੇ ਵਜੇ ਖੁੱਲ੍ਹਦੀ ਹੈ ਕੀ ਟਾਈਮਿੰਗ ਹੈ ਔਰ ਇਹ ਰੋਜ਼ ਖੁੱਲਦਾ ਹੈ ਔਰ ਇਹ ਰੋਜ਼ ਖੁੱਲਦਾ ਹੈ ਠੀਕ ਹੈ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਹਾਂਜੀ ਜ਼ਰੂਰ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ